ਪਹਿਲਾਂ ਮੈਂ ਯੋਗ ਦਾ ਅਭਿਆਸ ਆਪਣੇ ਘਰ ਵਿੱਚ ਹੀ ਕਰਦੀ ਸੀ ਆਪਣੇ ਘਰ ਦੇ ਆਪਣੇ ਕਮਰੇ ਵਿੱਚ ਹੀ ਮੈਂ ਆਨਲਾਈਨ ਕਲਾਸ ਲਗਾਉਂਦੀ ਸੀ ਯੋਗਾ ਦੀ ਫਿਰ ਹੌਲੀ ਹੌਲੀ ਯੋਗਾ ਸਿੱਖ ਗਈ ਅਤੇ ਫਿਰ ਮੈਂ ਆਪ ਹੀ ਯੋਗਾ ਕਰਨ ਲੱਗ ਗਈ ਪਰ ਆਪਣੇ ਘਰ ਦੇ ਕਮਰੇ ਵਿੱਚ ਹੀ ਫਿਰ ਹੌਲੀ ਹੌਲੀ ਮੈਨੂੰ ਕਿਸੇ ਨੇ ਕਿਹਾ ਕਿ ਬਾਹਰ ਸਾਫ਼ ਚੰਗੀ ਹਵਾ ਵਿੱਚ ਤੁਹਾਨੂੰ ਯੋਗਾ ਕਰਨਾ ਚਾਹੀਦਾ ਹੈ ਤਾਂ ਫਿਰ ਮੈਂ ਹੌਲੀ ਹੌਲੀ ਉੱਥੇ ਜਾ ਕੇ ਯੋਗਾ ਕਰਨ ਲੱਗ ਗਈ ਬਾਹਰ ਸਾਡੇ ਪਾਰਕ ਵਿੱਚ ਸਾਰੇ ਆਉਂਦੇ ਸੀ ਉੱਥੇ ਅਸੀਂ ਯੋਗਾ ਕਰਦੇ ਸੀ ਪਰ ਜਦੋਂ ਮੈਂ ਦੇਖਿਆ ਕਿ ਮੈਂ ਜਦੋਂ ਅੰਦਰ ਯੋਗਾ ਕਰਦੀ ਸੀ ਤਾਂ ਮੈਨੂੰ ਇੰਨਾ ਇੰਨੀ ਸਫੂਰਤੀ ਨਹੀਂ ਮਿਲਦੀ ਸੀਗੀ ਇੰਨੇ ਜ਼ਿਆਦਾ ਮੇਰੇ ਵਿੱਚ ਐਨਰਜੀ ਨਹੀਂ ਆਉਂਦੀ ਸੀ ਪਰ ਜਦੋਂ ਅਸੀਂ ਬਾਹਰ ਯੋਗਾ ਕਰਦੇ ਹਾਂ ਜਦੋਂ ਬਾਕੀਆਂ ਦੇ ਨਾਲ ਹੀ ਯੋਗਾ ਕਰਦੇ ਹਾਂ ਗਰੁੱਪ ਵਿੱਚ ਬੈਠ ਕੇ ਸਾਰੇ ਇਕੱਠੇ ਹੋ ਕੇ ਯੋਗਾ ਕਰਦੇ ਹਾਂ ਉਹ ਯੋਗਾ ਕਰਨ ਦਾ ਮਜ਼ਾ ਵੀ ਬਹੁਤ ਜ਼ਿਆਦਾ ਆਉਂਦਾ ਅਤੇ ਉਹ ਜਗ੍ਹਾ ਹੁਣ ਹੌਲੀ ਹੌਲੀ ਕਰਕੇ ਮੇਰੇ ਲਈ ਬਹੁਤ ਜ਼ਿਆਦਾ ਸਪੈਸ਼ਲ ਹੋ ਗਈ ਕਿਉਂਕਿ ਉੱਥੇ ਜਦੋਂ ਜਾਂਦੇ ਹਾਂ ਸਾਰੇ ਮਿਲਦੇ ਹਾਂ ਸਾਰੇ ਆਪਣੀ ਕਹਾਣੀ ਦੱਸਦੇ ਹੈ ਕਿ ਸਾਡੇ ਨਾਲ ਪਹਿਲਾਂ ਸਾਡੀ ਜ਼ਿੰਦਗੀ ਕਿਵੇਂ ਸੀ ਫਿਰ ਯੋਗਾ ਦੇ ਆਉਣ ਨਾਲ ਸਾਡੀ ਜ਼ਿੰਦਗੀ ਵਿੱਚ ਕੀ ਤਬਦੀਲੀ ਆਈ ਤਾਂ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਲੋਕਾਂ ਦੀਆਂ ਕਹਾਣੀਆਂ ਸੁਣ ਕੇ ਮੇਰੀ ਯੋਗਾ ਵਿੱਚ ਦਿਲਚਸਪੀ ਹੋਰ ਜ਼ਿਆਦਾ ਵੱਧ ਗਈ ਕਿ ਯੋਗਾ ਤਾਂ ਹੈ ਹੀ ਬਹੁਤ ਵਧੀਆ ਚੀਜ਼ ਇਹ ਸੋਚ ਸੋਚ ਕੇ ਮੈਂ ਮੇਰੇ ਬੱਚੇ ਨੂੰ ਬਹੁਤ ਛੋਟੀ ਉਮਰ ਵਿੱਚ ਹੀ ਐਨਕ ਲੱਗ ਗਈ ਸੀ ਫਿਰ ਮੈਂ ਆਪਣੇ ਬੱਚੇ ਨੂੰ ਵੀ ਲੈ ਕੇ ਜਾਣ ਲੱਗ ਗਈ ਹੁਣ ਮੇਰੇ ਤੇ ਮੇਰੇ ਬੱਚੇ ਲਈ ਉਹ ਜਗ੍ਹਾ ਬਹੁਤ ਹੀ ਜ਼ਿਆਦਾ ਵਧੀਆ ਹੈ ਅਤੇ ਉਸ ਜਗ੍ਹਾ ਦਾ ਮਾਹੌਲ ਮੈਨੂੰ ਫੋਕਸ ਕਰਨ ਲਈ ਮੈਨੂੰ ਨੇਚਰ ਨਾਲ ਜੋੜਦਾ ਮੈਨੂੰ ਪ੍ਰਕ੍ਰਿਤੀ ਨਾਲ ਕਿ ਆਸ ਪਾਸ ਪੇੜ ਪੌਦੇ ਹੁੰਦੇ ਆ ਸੁਬਹਾ ਸੁਬਹਾ ਪੰਛੀਆਂ ਦੀ ਆਵਾਜ਼ ਆਉਂਦੀ ਹੈ ਤਾਂ ਬਹੁਤ ਵਧੀਆ ਦਿਨ ਦੀ ਸ਼ੁਰੂਆਤ ਹੁੰਦੀ ਹੈ ਮੇਰੀ ਵੀ ਅਤੇ ਮੇਰੇ ਬੱਚੇ ਦੀ ਵੀ ਤਾਂ ਇਸ ਨਾਲ ਪੂਰਾ ਦਿਨ ਹੀ ਬਹੁਤ ਵਧੀਆ ਨਿਕਲਦਾ ਹੈ ਬਹੁਤ ਵਧੀਆ ਤੁਹਾਡੇ ਵਿੱਚ ਇੱਕ ਸਕਾਰਾਤਮਕਤਾ ਆਉਂਦੀ ਹੈ ਅਤੇ ਉਹਦੇ ਨਾਲ ਤੁਹਾਡੇ ਘਰ ਦਾ ਮਾਹੌਲ ਵੀ ਬਹੁਤ ਵਧੀਆ ਰਹਿੰਦਾ ਸਿਰਫ਼ ਬਾਹਰ ਦਾ ਮਾਹੌਲ ਨਹੀਂ ਘਰ ਦਾ ਮਾਹੌਲ ਕਿਉਂਕਿ ਜੇ ਤੁਸੀਂ ਆਪ ਖੁਸ਼ ਹੋਵੇਗੇ ਤੁਹਾਡਾ ਆਪਣਾ ਮਨ ਖੁਸ਼ ਹੋਵੇਗਾ ਤਾਂ ਹੀ ਤੁਸੀਂ ਆਪਣੇ ਪਰਿਵਾਰ ਨੂੰ ਖੁਸ਼ ਰੱਖ ਸਕਦੇ ਹੋ ਤਾਂ ਯੋਗ ਅਭਿਆਸ ਕਰਨ ਨਾਲ ਬਾਹਰ ਜਾ ਕੇ ਕਰਨ ਨਾਲ ਉਹ ਜਗ੍ਹਾ ਮੇਰੇ ਲਈ ਬਹੁਤ ਜ਼ਿਆਦਾ ਹੁਣ ਵਿਸ਼ੇਸ਼ ਹੋ ਗਈ ਹੈ ਅਤੇ ਉਸ ਨਾਲ ਮੈਨੂੰ ਬਹੁਤ ਜ਼ਿਆਦਾ ਯੋਗਾ ਨਾਲ ਮੈਂ ਹੁਣ ਜੁੜ ਚੁੱਕੀ ਹਾਂ